ਨੌ ਜੂਨ ਦੋ ਹਜ਼ਾਰ ਦਸ ਦਸ ਅਕਤੂਬਰ ਦੋ ਹਜ਼ਾਰ ਅੱਠ ਵੀਹ ਜੁਲਾਈ ਦੋ ਹਜ਼ਾਰ ਪੰਜ ਪੰਜ ਦਸੰਬਰ ਦੋ ਹਜ਼ਾਰ ਤਿੰਨ ਇੱਕ ਅਗਸਤ ਉੱਨੀ ਸੌ ਛਿਆਨਵੇਂ